ਹਾਲ ਫਿਲਹਾਲ ਹੀ ਮੈਨੂੰ ਇੱਕ ਟੈਕਸਟ ਮੈਸੇਜ ਮਿਲਿਆ ਸੀ ਕਿ ਜਿਸ ਵਿੱਚ ਮੈਨੂੰ ਦੱਸਿਆ ਗਿਆ ਸੀ ਕਿ ਮੇਰਾ ਬਿਜਲੀ ਦਾ ਬੁਤਕਾਨ ਭੁਗਤਾਨ ਹੋ ਚੁੱਕਿਆ ਹੈ ਇਸ ਨੂੰ ਚੈੱਕ ਕਰਨ ਲਈ ਮੈਂ ਵੈਬਸਾਈਟ 'ਤੇ ਪੰਜਾਬ ਦੀ ਇ ਇਲੈਕਟ੍ਰੀਸਿਟੀ ਬੋਰਡ ਵਾਲੀ ਵੈਬਸਾਈਟ 'ਤੇ ਲੋਗਇਨ ਕੀਤਾ ਅਤੇ ਉੱਥੇ ਮੈਂ ਚੈੱਕ ਕੀਤਾ ਕੀ ਮੇਰਾ ਬਿਜਲੀ ਦਾ ਬਿਲ ਸਹੀ 'ਚ ਭਰਿਆ ਗਿਆ ਹੈ ਜਾਂ ਨਹੀਂ ਚੈੱਕ ਕਰਨ 'ਤੇ ਮੈਨੂੰ ਸ਼ੋ ਹੋਇਆ ਕਿ ਮੈਂ ਅਸਲੀ 'ਚ ਬਿਲ ਪੇ ਕਰ ਦਿੱਤਾ ਗਿਆ ਹੈ ਪਰ ਮੈਨੂੰ ਹੁਣ ਇਹ ਵੀ ਪੱਕਾ ਨਹੀਂ ਸੀ ਕਿ ਮੇਰਾ ਬਿਲ ਸਹੀ ਛਪਿਆ ਹੋਇਆ ਹੈ ਜਾਂ ਨਹੀਂ ਇਸ ਲਈ ਮੈਂ ਉਹਨਾਂ ਦੀ ਸੇਵਾ ਕੇਂਦਰ ਕੋਲ ਕੀਤੀ ਸਪਸ਼ਟੀਕਰਨ ਲਈ ਅਤੇ ਜਦੋਂ ਮੈਂ ਕੋਲ ਕੀਤੀ ਉਹਨਾਂ ਤੋਂ ਪੁੱਛਿਆ ਉਹਨਾਂ ਨੇ ਵੀ ਇਹੀ ਜਵਾਬ ਦਿੱਤਾ ਕਿ ਮੈਂ ਬਿਜਲੀ ਦਾ ਭਰ ਦਿੱਤਾ ਗਿਆ ਹੈ